ਪੰਜਾਬ ਵਿੱਚ ਬਹੁਤ ਹੀ ਪ੍ਰਮੁੱਖ ਖੇਡਾਂ ਹਨ ਜੋ ਕੀ ਸਾਨੂੰ ਸ਼ੁਰੂ ਤੋਂ ਹੀ ਸਕੂਲ ਵਿੱਚ ਸਿਖਾ ਦਿੱਤੀ ਜਾਂਦੀਆਂ ਹਨ ਜੋ ਕੀ ਸਾਨੂੰ ਸਕੂਲ ਤੋਂ ਸ਼ੁਰੂ ਤੋਂ ਹੀ ਸਰਕਾਰੀ ਸਕੂਲ ਹੋ ਗਏ ਇਹਨਾਂ ਵਿੱਚ ਸਾਨੂੰ ਪ੍ਰਾਪਤ ਹੋਣੀ ਸ਼ੁਰੂ ਹੋ ਜਾਂਦੀਆਂ ਹਨ ਸਪੋਰਟਸ ਹੋ ਗਏ ਕ੍ਰਿਕਟ ਹੋ ਗਿਆ ਕਬੱਡੀ ਹੋ ਗਈ ਇਹਨਾਂ ਦੇ ਪੰਜਾਬ ਵਿੱਚ ਬਹੁਤ ਜ਼ਿਆਦਾ ਅਲੱਗ ਅਲੱਗ ਸੰਸਥਾ ਅਤੇ ਟੂਰਨਾਮੈਂਟ ਵੀ ਟੂਰਨਾਮੈਂਟ ਵੀ ਹੁੰਦੇ ਹਨ ਤੋਂ ਜੋ ਸਾਨੂੰ ਸਕੂਲ ਵਿੱਚ ਹੀ ਕ੍ਰਿਕਟ ਖਿਡਾਏ ਜਾਂਦਾ ਹੈ ਪਿੰਡਾਂ ਦੀ ਗੱਲ ਕੀਤੀ ਜਾਵੇ ਤਾਂ ਪਿੰਡਾਂ ਵਿੱਚ ਬਹੁਤ ਜ਼ਿਆਦਾ ਵੀ ਵੀ ਆਈ ਪੀ ਬੰਦੇ ਵੀ ਆਈ ਪੀ ਕਲਚਰ ਜਿੰਨੇ ਵੀ ਆ ਬਾਹਰੋਂ ਚਾਰ ਪੈਸੇ ਭੇਜਦੇ ਹਨ ਇੱਥੇ ਟੂਰਨਾਮੈਂਟ ਕਰਵਾਉਂਦੇ ਹਨ ਅਗਰ ਗੱਲ ਕੀਤੀ ਜਾਵੇ ਐੱਮ ਐੱਲ ਏ ਦੀ ਐੱਮ ਐੱਲ ਏ ਵੀ ਸਾਲ 'ਚ ਇੱਕ ਵਾਰੀ ਇੱਥੇ ਟੂਰਨਾਮੈਂਟ ਕਰਾਂਉਂਦੇ ਹਨ ਸਟੇਡੀਅਮ 'ਚੇ ਪਿੰਡਾਂ 'ਚੇ ਅਤੇ ਪਿੰਡਾਂ ਦੇ ਵੀ ਕੱਠ ਇਕੱਠੇ ਹੋ ਕੇ ਟੂਰਨਾਮੈਂਟ ਹੁੰਦੇ ਹਨ ਇਹਨਾਂ ਟੂਰਨਾਮੈਂਟ ਕਾਫੀ ਜਣੇ ਬੰਦੇ ਬਾਹਰੋਂ ਆ ਕੇ ਓਪਨ 'ਚੇ ਸਟੇਟ 'ਤੇ ਖੇਡਦੇ ਹਨ ਹਿੱਸਾ ਲੈਂਦੇ ਹਨ ਅਗਰ ਕ੍ਰਿਕਟ ਵੀ ਹੁੰਦਾ ਟੂਰ ਨਾ ਹੋਰ ਟੂਰ ਕਬੱਡੀ ਦੇ ਟੂਰਨਾਮੈਂਟ ਹੋ ਗਿਆ ਅਤੇ ਬਾਲੀਬਾਲ ਦਾ ਟੂਰਨਾਮੈਂਟ ਹੋ ਗਿਆ ਹਰੇਕ ਚੀਜ਼ ਦਾ ਉਰੇ ਟੂਰਨਾਮੈਂਟ ਹੁੰਦਾ ਹੈ